ਛੱਬੀ ਦਸੰਬਰ ਉੱਨੀ ਸੌ ਇਕਿਆਸੀ ਪੰਜ ਅਕਤੂਬਰ ਦੋ ਹਜ਼ਾਰ ਗਿਆਰ੍ਹਾਂ ਅਠਾਰ੍ਹਾਂ ਜਨਵਰੀ ਦੋ ਹਜ਼ਾਰ ਅਠਾਰ੍ਹਾਂ ਬਾਰ੍ਹਾਂ ਜੁਲਾਈ ਉੱਨੀ ਸੌ ਅਠਾਸੀ ਤੇਰ੍ਹਾਂ ਜਨਵਰੀ ਦੋ ਹਜ਼ਾਰ ਸੋਲ੍ਹਾਂ